ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਉੱਦਾਂ ਤਾਂ ਬਹੁਤ ਸਾਰੇ ਗੀਤ ਹਨ ਪਰ ਮੈਂ ਅੱਜ ਤੁਹਾਨੂੰ ਆਪਣੇ ਪਸੰਦੀਦਾਰ ਗੀਤ ਬਾਰੇ ਦੱਸਣਾ ਚਾਹਵਾਂਗੀ ਪੰਜਾਬ ਵਿੱਚ ਹਰ ਤਿਉਹਾਰ ਦੇ ਉੱਤੇ ਹਰੇਕ ਅਲੱਗ ਅਲੱਗ ਗੀਤ ਗਾ ਕੇ ਤਿਉਹਾਰ ਨੂੰ ਬੜਾ ਹੀ ਚੰਗਾ ਅਤੇ ਵਧੀਆ ਬਣਾਇਆ ਜਾਂਦਾ ਹੈ ਅਤੇ ਮਜੇਦਾਰ ਬਣਾਇਆ ਜਾਂਦਾ ਹੈ ਜਿੱਦਾਂ ਕਿ ਹੁਣੇ ਹੁਣੇ ਇੱਕ ਲੋਹੜੀ ਦਾ ਤਿਉਹਾਰ ਲੰਘਿਆ ਹੈ ਅਤੇ ਉਸ ਦੇ ਉੱਤੇ ਮੈਂ ਇੱਕ ਗੀਤ ਬੋਲਿਆ ਸੀ ਜੋ ਮੈਨੂੰ ਬੜਾ ਹੀ ਚੰਗਾ ਲੱਗਦਾ ਹੈ ਉਹ ਮੈਨੂੰ ਇਸ ਕਰਕੇ ਚੰਗਾ ਲੱਗਦਾ ਹੈ ਕਿ ਉਹਨੂੰ ਬੋਲਣ ਦਾ ਲਹਿਜਾ ਬੜਾ ਵਧੀਆ ਹੈ ਉਹ ਇੱਕ ਅਲੱਗ ਹੀ ਤਰ੍ਹਾਂ ਨਾਲ ਬੋਲ ਕੇ ਇੱਕ ਅਲੱਗ ਹੀ ਮਜ਼ੇਦਾਰ ਟਿਊਨ ਵਿੱਚ ਬੋਲਿਆ ਜਾਂਦਾ ਹੈ ਅਤੇ ਉਹ ਬੜਾ ਹੀ ਵਧੀਆ ਗੀਤ ਲੱਗਦਾ ਆ ਮੈਨੂੰ ਕਿ ਅਤੇ ਉਹ ਜ਼ਿਆਦਾਤਰ ਲੋਹੜੀ 'ਤੇ ਹੀ ਬੋਲਿਆ ਜਾਂਦਾ ਅਤੇ ਲੋਹੜੀ ਤੋਂ ਕੁਝ ਕੁ ਦਿਨ ਪਹਿਲਾਂ ਲੋਹੜੀ ਮੰਗਣ ਵਾਸਤੇ ਵੀ ਬੱਚੇ ਇਸ ਦਾ ਇਸਤੇਮਾਲ ਕਰਦੇ ਹਨ ਜਿੱਦਾਂ ਕਿ ਉਹ ਗਾਣਾ ਇਹ ਆ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਚਾਰਾ ਹੋਏ ਦੁੱਲਾ ਭੱਟੀ ਵਾਲਾ ਹੋਏ ਦੁੱਲੇ ਦੀ ਧੀ ਵਿਆਹੀ ਹੋਏ ਹੁਣ ਤੁਸੀਂ ਇਸ ਨੂੰ ਸੁਣ ਕੇ ਆਪ ਹੀ ਪਤਾ ਕਰ ਸਕਦੇ ਹੋ ਕਿ ਇਹਨੂੰ ਬੋਲ ਕੇ ਅਸੀਂ ਬੋਲੀਆਂ ਵੀ ਪਾ ਸਕਦੇ ਹਾਂ ਕਿੰਨਾ ਅਲੱਗ ਹੀ ਤਰ੍ਹਾਂ ਦਾ ਇਹਦੇ 'ਚ ਉਤਸ਼ਾਹ ਆ ਕਿੰਨਾ ਮਜ਼ੇਦਾਰ ਗੀਤ ਆ ਅਤੇ ਮੈਨੂੰ ਸਭ ਤੋਂ ਵਧੀਆ ਇਹ ਹੀ ਓ ਲੱਗਦਾ ਕਿਉਂਕਿ ਇਸ ਨੂੰ ਆਪਾਂ ਬੋਲ ਕੇ ਆਪਾਂ ਤਿਉਹਾਰ ਨੂੰ ਵਧੀਆ ਵੀ ਬਣਾ ਸਕਦੇ ਹਾਂ ਅਤੇ ਬੜਾ ਹੀ ਜੋਸ਼ ਭਰਿਆ ਗੀਤ ਹੈ ਧੰਨਵਾਦ